ਹੈਲੋ ਹਾਂਜੀ ਮੈਨੂੰ ਕੋਟੀਆਂ ਸਵੈਟਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਵੈਸੇ ਮੈਂ ਹਰੇਕ ਬੁਣਤੀ ਪਾ ਲੈਂਦੀ ਹਾਂ ਹਰੇਕ ਫੁੱਲ ਪਾ ਲੈਦੀ ਹਾਂ ਹਰੇਕ ਤਰ੍ਹਾਂ ਦੀ ਕੋਟੀ ਬੁਣ ਲੈਦੀ ਹਾਂ ਕਸਟਮਰ ਕਈ ਵਾਰੀ ਕਹਿ ਦਿੰਦੇ ਹੁੰਦੇ ਆ ਵੀ ਮੈਡਮ ਇਹ ਜਿਹੀ ਕੋਟੀ ਬੁਣ ਦਿਓ ਫਿਰ ਆਪਾਂ ਕੋਟੀ ਉਹੋ ਜਿਹੀ ਦੇਖ ਕੇ ਪਾ ਦਿੰਦੇ ਹੁੰਦੇ ਹਾਂ ਜਿਹੋ ਜਿਹਾ ਨਮੂਨਾ ਹੋਵੇ ਉਹੋ ਜਿਹੀ ਕੋਟੀ ਆਪਾਂ ਬੁਣ ਦਿੰਦੇ ਹੁੰਦੇ ਹਾਂ ਵੈਸੇ ਕਈ ਵਾਰੀ ਕਈ ਵਾਰੀ ਕੋਟੀ ਛੋਟੀ ਵੱਡੀ ਭੀੜੀ ਹੋ ਸਕਦੀ ਹੈ ਅਤੇ ਕਸਟਮਰ ਕਹਿ ਵੀ ਦਿੰਦੇ ਆ ਵੀ ਮੈਡਮ ਆਹਾਂ ਭੀੜੀ ਆ ਜਾਂ ਖੁੱਲ੍ਹੀ ਕਰ ਦਿਓ ਜਾਂ ਕਿਵੇਂ ਕਰੋ ਫਿਰ ਆਪਾਂ ਉਹਨੂੰ ਗਲਾ ਦੇੜ ਦੇਈ ਦਾ ਗਲਾ ਦੇੜ ਕੇ ਕਾਟ ਹੋਰ ਪਾ ਦੇਈ ਦੀ ਆ ਕਾਟ ਪਾ ਕੇ ਉਹਨੂੰ ਵੱਡੀ ਕਰ ਦੇਈ ਦੇ ਆ ਵੱਡੀ ਕਰਕੇ ਫਿਰ ਗੁਲਾਬ ਦੇ ਫੁੱਲ ਵੀ ਵੈਸੇ ਜਿਵੇਂ ਵੀ ਕਹਿ ਦਿੰਦੇ ਆ ਆਪਾਂ ਨੈੱਟ ਤੋਂ ਕੱਢ ਕੇ ਵੀ ਬੁਣ ਦਿੰਦੇ ਹਾਂ ਪਾ ਦਿੰਦੇ ਹਾਂ ਛੋਟੇ ਬੱਚਿਆਂ ਦੀਆਂ ਵੀ ਬੁਣ ਦਿੰਦੇ ਹਾਂ ਵੱਡਿਆਂ ਦੀਆਂ ਵੀ ਬੁਣ ਦਿੰਦੇ ਹਾਂ ਜਿਹੋ ਜਿਹੇ ਕਸਟਮਰ ਆ ਜਾਂਦੇ ਆ ਉਹੀ ਚੀਜ਼ ਬੁਣ ਦਈਦੀ ਆ ਵੈਸੇ ਮੈਨੂੰ ਸ਼ੌਂਕ ਵੀ ਬਹੁਤ ਆ ਕੋਟੀਆਂ ਦਾ ਜਾਕਟਾਂ ਦਾ ਸਵੈਟਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਸ਼ੁਰੂ ਤੋਂ ਹੀ ਸ਼ੌਂਕ ਆ ਮੈਨੂੰ ਸ਼ੁਰੂ ਤੋਂ ਮੈਂ ਬੁਣਦੀ ਹਾਂ ਕਈ ਵਾਰੀ ਹੋ ਵੀ ਜਾਂਦਾ ਹੈਗਾ ਬੁਣਦਿਆਂ ਤੋਂ ਵੱਡਾ ਗਲਾ ਹੋ ਜਾਂਦਾ ਕਈ ਵਾਰੀ ਗਲਾ ਛੋਟਾ ਹੋ ਜਾਂਦਾ ਕਈ ਵਾਰੀ ਕਾਟ ਘੱਟ ਪੈ ਸਕਦੀ ਆ ਉਹਨੂੰ ਫਿਰ ਮੈਂ ਦੇੜ ਕੇ ਫਿਰ ਮੈਂ ਦੁਬਾਰਾ ਬੁਣ ਦਿੰਦੀ ਹਾਂ ਜੇ ਕੋਈ ਕਹਿ ਵੀ ਦੇਵੇ ਵੀ ਮੈਡਮ ਸੈੱਟ ਚਾਹੀਦਾ ਸਾਨੂੰ ਕੋਟੀ ਸੈੱਟ ਚਾਹੀਦਾ ਫਿਰ ਆਪਾਂ ਕੋਟੀ ਸੈੱਟ ਵੀ ਬੁਣ ਦਿੰਦੇ ਹਾਂ ਜੇ ਕੋਈ ਕਹੇ ਜਾਕਟ ਚਾਹੀਦੀ ਆਪਾਂ ਜਾਕਟ ਵੀ ਬੁਣ ਦਿੰਦੇ ਹਾਂ ਜਿਵੇਂ ਜਿਵੇਂ ਤਰ੍ਹਾਂ ਦੇ ਆਉਂਦੇ ਆ ਜੁਰਾਬਾਂ ਦਾ ਕਹਿੰਦਾ ਜੁਰਾਬਾਂ ਦਾ ਦਸਤਾਨਿਆਂ ਦਾ ਅਤੇ ਟੋਪੀਆਂ ਦਾ ਕੋਈ ਵੀ ਕੁਛ ਕਿਵੇਂ ਕਸਟਮਰ ਆ ਜੇ ਆਪਾਂ ਉਹੀ ਕਸਟਮਰ ਦੀ ਖਵਾਹਿਸ਼ ਪੂਰੀ ਕਰ ਦਿੰਦੇ ਹਾਂ ਹਰੇਕ ਤਰ੍ਹਾਂ ਦਾ ਆਪਾਂ ਬੁਣਤੀ ਪਾ ਲਈ ਦੇ ਆ ਹਰੇਕ ਤਰ੍ਹਾਂ ਦੀ ਆਪਾਂ ਬੁਣ ਲੈਂਦੇ ਹਾਂ ਜਿਵੇਂ ਵੀ ਕੋਈ ਆਪਣੇ ਕੋਲ ਆ ਸਕਦਾ ਵੀ ਮੈਡਮ ਟੋਪੀ ਇਸ ਤਰ੍ਹਾਂ ਦੀ ਲੈਣੀ ਆ ਜੁਰਾਬ ਇਸ ਤਰ੍ਹਾਂ ਦੀ ਲੈਣੀ ਆ ਦਸਤਾਨੇ ਇਸ ਤਰ੍ਹਾਂ ਦੇ ਬੁਣਨੇ ਆ ਆਪਾਂ ਹੈ ਨਾ ਆਪਾਂ ਉਵੇਂ ਹੀ ਬੁਣ ਦੇਈ ਦਾ ਵੈਸੇ ਮੈਨੂੰ ਸ਼ੁਰੂ ਤੋਂ ਬਹੁਤ ਇਹੋ ਜਿਹੀਆਂ ਚੀਜ਼ਾਂ ਦਾ ਸ਼ੌਂਕ ਆ ਸ਼ੌਂਕ ਕਰਕੇ ਮੈਂ ਬੁਣਦੀ ਹੈਗੀ ਜੇ ਕੋਈ ਆ ਜੇ ਮੇਰੇ ਕੋਲ ਵੀ ਮੈਡਮ ਆਪਾਂ ਪੱਛਮ ਦਾ ਸਵਾਟਰ ਦੇ ਨਾਲ ਦਾ ਆਪਾਂ ਜੈਕਟ ਦੇ ਨਾਲ ਦਾ ਸ਼ੋਲ ਬਣਾਉਣਾ ਗਾ ਆਪਾਂ ਉਹ ਵੀ ਬੁਣ ਦਿੰਦੇ ਹਾਂ ਕਰੋਸ਼ੀਏ ਦਾ ਵੀ ਸ਼ੌਂਕ ਆ ਸਲਾਈਆਂ ਦਾ ਵੀ ਸ਼ੌਂਕ ਆ ਸਾਰਾ ਹੀ ਸ਼ੌਂਕ ਆ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਆ ਅਤੇ ਸ਼ੁਰੂ ਤੋਂ ਹੀ ਮੈਂ ਇਹ ਕੰਮ ਕਰਦੀ ਆਈ ਹਾਂ ਅਤੇ ਕਰਦੇ ਰਹਿਣਾ ਮੈਨੂੰ ਬੜਾ ਸ਼ੌਂਕ ਆ ਪੰਜਾਬੀ ਚੀਜ਼ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਗਾ ਹੁਣ ਵੀ ਮੈਂ ਆਪਣੇ ਪੋਤਰੇ ਦੀ ਕੋਟੀ ਬੁਣੀ ਹੈ ਛੋਟੀ ਜਿਹੀ ਬੁਣੀ ਆ ਉਹਦੇ ਨਾਲ ਸਾਰਾ ਬਿੱਬ ਵਾਲਾ ਬੁਣਿਆ ਪਜਾਮੀ ਬੁਣੀ ਆ ਟੋਪੀ ਆ ਕੋਟੀ ਹੈ ਨਾਲ ਬਹੁਤ ਸੋਹਣਾ ਬੁਣਿਆ ਗਾ ਹਜੇ ਵੀ ਮੈਨੂੰ ਬਹੁਤ ਸ਼ੌਂਕ ਆ ਆਪਣੀਆਂ ਵੀ ਮੈਂ ਬੁਣ ਲੈਦੀ ਹਾਂ ਸਾਰੀ ਫੈਮਿਲੀ ਦੀਆਂ ਵੀ ਬੁਣ ਦਿੰਦੀ ਹਾਂ ਜੇ ਕੋਈ ਆਵੇ ਉਹਦੀਆਂ ਬੁਣ ਵੀ ਦੇਈ ਦੀਆਂ ਅਤੇ ਵੈਸੇ ਆਪਣੀਆਂ ਹੀ ਮੈਂ ਜ਼ਿਆਦਾ ਘਰ ਬੁਣਦੀ ਹਾਂ ਜੀ ਬੜੀਆਂ